ਹੈਲੋ ਹਾਂਜੀ ਮੁਸਾਫਕ ਗੈਸ ਸਰਵਿਸ ਤੋਂ ਗੱਲ ਕਰ ਰਹੇ ਹੋ ਸਰ ਸਰ ਮੈਂ ਰਮਨ ਗੱਲ ਕਰ ਰਿਹਾ ਰਮਨ ਚਾਮ ਫਾਜ਼ਿਲਕਾ ਤੋਂ ਹੀ ਥੋੜ੍ਹੇ ਦਿਨ ਨਾ ਸਰ ਪਹਿਲਾਂ ਮੈਂ ਇੱਕ ਗੈਸ ਦੀ ਬੁਕਿੰਗ ਵਾਸਤੇ ਗੈਸ ਏਜੰਸੀ 'ਚ ਫੋਨ ਕੀਤਾ ਸੀ ਮੈਨੂੰ ਇੱਕ ਜੋ ਗੈਸ ਚੁੱਲ੍ਹੇ ਦੀ ਜ਼ਰੂਰਤ ਸੀਗੀ ਨਵੇਂ ਕਨੈਕਸ਼ਨ ਲੈਣਾ ਸੀ ਮੈਂ ਪਰ ਉਹ ਸਰ ਉਹ ਮੇਰਾ ਥੋੜ੍ਹਾ ਜਿਹਾ ਮਾਇੰਡ ਚੇਂਜ ਕਰਕੇ ਨਾ ਮੈਂ ਉਹਨੂੰ ਬਿਜਲੀ ਦਾ ਇੱਕ ਉਹ ਇਲੈਕਟਰੋਨਿਕ ਚੁੱਲ੍ਹਾ ਲਿਆ ਆ ਸਰ ਅਤੇ ਉਹ ਹੁਣ ਸਰ ਮੈਨੂੰ ਉਹ ਜਿਸ ਗੈਸ ਚੁੱਲ੍ਹੇ ਦੀ ਜ਼ਰੂਰਤ ਨਹੀਂ ਇਹ ਨਵਾਂ ਕਨੈਕਸ਼ਨ ਨਹੀਂ ਚਾਹੀਦਾ ਤਾਂ ਤੁਸੀਂ ਉਹ ਪਲੀਜ਼ ਉਹਨੂੰ ਕੈਂਸਲ ਕਰ ਦਿਓ ਮੇਰੀ ਬੁਕਿੰਗ ਔਰ ਮੈਂ ਉਹਦੀ ਪੇਮੈਂਟ ਵੀ ਪਹਿਲਾਂ ਕੀਤੀ ਸੀਗੀ ਸਰ ਜੋ ਵੀ ਤੋ ਤੁਸੀਂ ਰਿਫੰਡ ਕਰ ਦੇਣਾ ਮੇਰੇ ਗੂਗਲ ਪੇ 'ਤੇ ਕਰ ਦਿਓ ਜਾਂ ਕੈਸ਼ ਜਿਵੇਂ ਵੀ ਤੁਸੀਂ ਪੇ ਤੁਹਾਡਾ ਪ੍ਰੋਸੀਜਰ ਹੈ ਤੋ ਪਲੀਜ਼ ਤੁਸੀਂ ਰਿਕੁਐਸਟ ਹੈ ਮੇਰੀ ਅਤੇ ਉਹ ਕੰਜੀਊਮਰ ਆਈ ਡੀ ਮੇਰੀ ਦੱਸ ਦਿੰਦਾ ਤੁਹਾਨੂੰ ਮੈਂ ਮੇਰਾ ਬਾਰਾਂ ਸੌ ਪੰਜਾਹ ਨੰਬਰ ਹੈ ਵੰਨ ਟੂ ਫਾਈਵ ਜ਼ੀਰੋ ਇਸ ਨੰਬਰ 'ਤੇ ਮੈਂ ਪਰਸੋਂ ਹੀ ਕਰਵਾ ਕੇ ਗਿਆ ਸਰ ਅਤੇ ਤੁਸੀਂ ਉਹ ਚੈੱਕ ਕਰ ਲਓ ਮੈਂ ਡਾਕੂਮੈਂਟਸ ਵਗੈਰਾ ਤੁਹਾਨੂੰ ਵਾਪਸ ਅਗਰ ਕਹੋ ਤਾਂ ਮੈਂ ਤੁਹਾਡੇ ਆਫਿਸ ਆ ਜਾਂਦਾ ਅਤੇ ਜਿਵੇਂ ਵੀ ਤੁਹਾਡਾ ਪ੍ਰੋਸੈਸ ਚੱਲਦਾ ਅੱਗੇ ਕੈਂਸਲ ਕਰਨ ਦਾ ਉਹ ਮੈਨੂੰ ਦੱਸ ਦਿਓ ਤੁਸੀਂ ਅਤੇ ਮੈਂ ਉਹ ਕੈਂਸਲ ਕਰਵਾਉਣਾ ਚਾਹੁੰਦਾ ਅਤੇ ਪਲੀਜ਼ ਜਲਦੀ ਤੋਂ ਜਲਦੀ ਉਹ ਕੈਂਸਲ ਕਰ ਦੇਆ ਜੇ ਮੈਨੂੰ ਉਹਨਾਂ ਦੀ ਜ਼ਰੂਰਤ ਨਹੀਂ ਰਹੀ ਥੈਂਕ ਯੂ